ਹੈਲੋ ਸਰ ਹਾਂਜੀ ਐਮਜੋਨ ਤੋਂ ਬੋਲ ਰਹੇ ਹੋ ਮੈਂ ਉੱਥੋਂ ਬੈਡ ਸ਼ੀਟ ਮੰਗਵਾਈ ਸੀਗੀ ਉਹ ਬੈਡ ਸ਼ੀਟ ਬਹੁਤ ਬੇਕਾਰ ਆਈ ਹੈ ਉਹਦਾ ਕਲਰ ਵੀ ਬਹੁਤ ਬੇਕਾਰ ਹੈ ਉਹ ਉਸਦਾ ਪ੍ਰਿੰਟ ਵੀ ਸੋਹਣਾ ਨਹੀਂ ਅਤੇ ਜਦੋਂ ਉਸ ਨੂੰ ਬੈਡ 'ਤੇ ਵਿਛਾਉਂਦੇ ਹਾਂ ਤਾਂ ਉਹ ਇਕੱਠੀ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਉਹ ਬੈਡ ਸ਼ੀਟ ਚੇਂਜ ਬਦਲ ਦਿਓ ਅਤੇ ਜਾਂ ਉਹਦੀ ਜਗ੍ਹਾ 'ਤੇ ਕੋਈ ਹੋਰ ਬੈਡ ਸ਼ੀਟ ਦੇ ਦਿਓ ਉਹਦਾ ਕਲਰ ਸੋਹਣਾ ਨਹੀਂ ਬਿਲਕੁਲ ਹੀ ਮੈਨੂੰ ਪਸੰਦ ਨਹੀਂ ਜਦੋਂ ਉਹਨੂੰ ਇਕੱਠੀ ਕਰਦੇ ਆ ਤਾਂ ਉਹਦਾ ਕਲਰ ਹੱਥਾਂ ਨੂੰ ਲੱਗ ਜਾਂਦਾ ਹੈ ਇਸ ਇਸ ਕਰਕੇ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਬੈਡ ਸ਼ੀਟ ਸੋਹਣੀ ਮਿਲਣੀ ਚਾਹੀਦੀ ਹੈ ਤਾ ਕਿ ਅਸੀਂ ਤੁਹਾਡੇ ਤੋਂ ਹੋਰ ਸੋਹਣੀ ਬੈਡ ਸ਼ੀਟ ਮੰਗਵਾ ਸਕੀਏ ਬੈਡ ਸ਼ੀਟ 'ਤੇ ਬੱਚੇ ਜਦੋਂ ਬੈਠਦੇ ਹੈ ਬੈਡ ਸ਼ੀਟ ਇਕੱਠੀ ਹੋ ਜਾਂਦੀ ਹੈ ਇਸ ਕਰਕੇ ਪਲੀਜ਼ ਸਾਨੂੰ ਹੋਰ ਬੈਡ ਸ਼ੀਟ ਲਿਆ ਦਿਓ ਇਸ ਕਰਕੇ ਹੋਰ ਬੈਡ ਸ਼ੀਟ ਵਧੀਆ ਸੋਹਣੀ ਰੰਗ ਦੀ ਲਿਆ ਦਿਓ ਥੈਂਕ ਯੂ